ਪਕਵਾਨ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਹਲਵਾ ਖੀਰ ਪੂੜਾ ਜਲੇਬੀ ਰਸਗੁੱਲਾ

ਫੇਰ ਇਸ ਨੂੰ ਮਿਕਸੀ ਦੇ ਵਿੱਚ ਪੀਸਣਾ ਹੈ ਫੇਰ ਦੇਸੀ ਘਿਓ ਪਾ ਕੇ ਨਿੰਮੀ ਆਂਚ 'ਤੇ ਇਸ ਨੂੰ ਪਕਾਉਣਾ ਹੈ ਅਤੇ ਗੈਸ ਨੂੰ ਹਲਕਾ ਹੋ ਕੇ ਰੱਖਣਾ ਹੈ ਜਦੋਂ ਅਸੀਂ ਇਸ ਨੂੰ ਅੱਗ 'ਤੇ ਪਕਾਉਂਦੇ ਹਾਂ ਤਾਂ ਸਾਰਾ ਘਿਓ ਪੀ ਜਾਂਦੀ ਹੈ ਅਤੇ ਦੂਜੇ ਪਾਸੇ ਜਿੰਨਾ ਚਿਰ ਦਾਲ ਪੱਕਦੀ ਹੈ ਤਾਂ ਦੂਜੇ ਪਾਸੇ ਚਾਸ਼ਨੀ ਬਣਾਉਣੀ ਹੈ ਚਾਸ਼ਨੀ ਬਣਾਉਣ ਵੇਲੇ ਉਸ ਵਿੱਚ ਇਲਾਇਚੀ ਪਾਊਡਰ ਮਿਲਾ ਦੇਣਾ ਚਾਹੀਦਾ ਹੈ ਤਾਂ ਜੋ ਇਸ ਦਾ ਸਵਾਦ ਵਧੀਆ ਹੋ ਜਾਵੇ ਦੂਜੇ ਪਾਸੇ ਸਾਨੂੰ ਦਾਲ ਨੂੰ ਉਸ ਵੇਲੇ ਤੱਕ ਪਕਾਉਣਾ ਹੈ ਜਦ ਤੱਕ ਉਸਦਾ ਰੰਗ ਹਲਕਾ ਭੂਰਾ ਨਾ ਹੋ ਜਾਵੇ ਜਦੋਂ ਇਸ ਦਾ ਰੰਗ ਹਲਕਾ ਭੂਰਾ ਹੋ ਜਾਵੇ ਤਾਂ ਬਣਾਈ ਹੋਈ ਚਾਸ਼ਨੀ ਦਾਲ ਵਿੱਚ ਪਾ ਦੇਣੀ ਹੈ ਅਤੇ ਗੈਸ ਦੀ ਲੋਅ ਤੇਜ਼ ਕਰ ਦੇਣੀ ਹੈ ਫਿਰ ਸਾਡਾ ਹਲਵਾ ਬਣ ਕੇ ਤਿਆਰ ਹੋ ਜਾਂਦਾ ਹੈ ਅਤੇ ਤਿਆਰ ਹਲ ਤਿਆਰ ਹੋਣ 'ਤੇ ਇਸ 'ਤੇ ਬਦਾਮ ਪਿਸਤਾ ਆਦਿ ਪਾ ਸਕਦੇ ਹਾਂ ਇਸ ਤਰ੍ਹਾਂ ਮੂੰਗੀ ਦਾਲ ਦਾ ਹਲਵਾ ਤਿਆਰ ਕੀਤਾ ਜਾਂਦਾ ਹੈ